ਜਿਵੇਂ ਕਿ ਅੱਜ ਕੱਲ੍ਹ ਤੁਸੀਂ ਦੇਖਦੇ ਹੀ ਓਂ ਕਿ ਪੰਜਾਬੀ ਸੱਭਿਆਚਾਰ ਦੇ ਵਿੱਚ ਬਹੁਤ ਸਾਰੇ ਰੀਤੀ ਰਿਵਾਜ਼ ਅਤੇ ਪਰੰਪਰਾਵਾਂ ਆਉਂਦੀਆਂ ਹਨ ਉਹਨਾਂ ਰੀਤੀ ਰਿਵਾਜ਼ਾਂ ਦੇ ਵਿੱਚੋਂ ਇਹ ਪਰੰਪਰਾਵਾਂ ਦੇ ਵਿੱਚੋਂ ਇੱਕ ਰੀਤੀ ਰਿਵਾਜ਼ ਜਿਹੜਾ ਕਿ ਵਿਆਹ ਦਾ ਹੈ ਵਿਆਹ ਦੇ ਵਿੱਚ ਤੁਸੀਂ ਦੇਖਿਆ ਹੀ ਹੋਣਾ ਹੈਗਾ ਆ ਕਿ ਬਹੁਤ ਸਾਰੇ ਰੀਤੀ ਰਿਵਾਜ਼ ਉਹਦੇ ਵਿੱਚ ਫੋਲੋ ਕੀਤੇ ਜਾਂਦੇ ਹਨ ਜਿਵੇਂ ਕਿ ਕੋਈ ਵੀ ਵਿਆਹ ਹੋਣ ਤੋਂ ਪਹਿਲਾਂ ਉੱਥੇ ਘੋੜੀਆਂ ਅਤੇ ਸੁਹਾਗ ਗਾਏ ਜਾਂਦੇ ਹਨ ਅਤੇ ਇਹ ਸਾਰਾ ਕੁਛ ਪਿਆਹ ਵਿਆਹ ਦੇ ਰੀਤੀ ਰਿਵਾਜ਼ਾਂ ਦੇ ਵਿੱਚ ਹੀ ਆਉਂਦਾ ਹੈਗਾ ਏ ਆ ਅਤੇ ਵਿਆਹ ਦੇ ਰੀਤੀ ਰਿਵਾਜ਼ਾਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਜਿਹੜੀਆਂ ਕਿ ਪੰਜਾਬੀ ਵਿਆਹ ਦੇ ਵਿੱਚ ਅਸੀਂ ਫੋਲੋ ਕਰਦੇ ਹੈਗੇ ਹਾਂ ਜੇਕਰ ਅਸੀਂ ਕਿਸੇ ਵੀ ਕੁੜੀ ਜਾਂ ਮੁੰਡੇ ਦਾ ਵਿਆਹ ਕਰਨਾ ਹੈਗਾ ਏ ਆ ਤਾਂ ਇਹ ਸਾਰੀਆਂ ਪਰੰਪਰਾਵਾਂ ਅਤੇ ਰੀਤੀ ਰਿਵਾਜ਼ ਅਪਣਾਏ ਜਾਂਦੇ ਹਨ ਵਿਆਹ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਮਹੱਤਵਪੂਰਨ ਕਾਰਕ ਹੁੰਦੇ ਹਨ ਜਿਹੜੇ ਕਿ ਕਰਨ ਤੋਂ ਪਹਿਲਾਂ ਅਸੀਂ ਕੋਈ ਕਈ ਰੀਤੀ ਰਿਵਾਜ਼ ਉਹਦੇ ਵਿੱਚ ਅਪਣਾਉਂਦੇ ਹੈਗੀ ਆ ਜੇ ਅਸੀਂ ਡਰੈਸ ਦੀ ਗੱਲ ਕਰੀਏ ਤਾਂ ਲਿਟਰੇਚਰ ਦੀ ਗੱਲ ਕਰੀਏ ਤਾਂ ਸੌਂਗ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਬਹੁਤ ਸਾਰੇ ਰੀਤੀ ਰਿਵਾਜ਼ ਆਉਂਦੇ ਹੈਗੇ ਹਨ ਜੇ ਅਸੀਂ ਆਪਣੇ ਪੰਜਾਬੀ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਜਿੰਦਾ ਰੱਖਣਾ ਚਾਹੁੰਦੇ ਹੈਗੇ ਹਾਂ ਤਾਂ ਸਾਨੂੰ ਇਹਨਾਂ ਰੀਤੀ ਰਿਵਾਜ਼ਾਂ ਨੂੰ ਅੱਗੇ ਤੱਕ ਮੰਨਣਾ ਚਾਹੀਦਾ ਹੈ ਇਹਦੇ ਵਿੱਚ ਕਈ ਰੀਤੀ ਰਿਵਾਜ਼ ਇੱਦਾਂ ਦੇ ਹਨ ਜਿਹੜੇ ਕਿ ਸਾਡੇ ਲਈ ਬਹੁਤ ਫਾਇਦੇ ਵੀ ਹੁੰਦੇ ਹਨ ਅਤੇ ਕਈ ਰੀਤੀ ਰਿਵਾਜ਼ ਇੱਦਾਂ ਦੇ ਵੀ ਹੈਗੇ ਜਿੰਨਾਂ ਨੂੰ ਸਾਨੂੰ ਖਤਮ ਕਰਨਾ ਚਾਹੀਦਾ ਹੈਗਾ ਜਿਵੇਂ ਕਿ ਇਹਨਾਂ ਦੇ ਵਿੱਚੋਂ ਇੱਕ ਆਉਂਦਾ ਹੈਗਾ ਕਿ ਕੁੜੀ ਨੂੰ ਘਰ ਤੋਂ ਬਾਹਰ ਨਹੀਂ ਕੱਢਣਾ ਅਤੇ ਉਹ ਮਤਲਬ ਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਨਹੀਂ ਕਰਵਾਉਣੀ ਹੈਗੀ ਆ ਪੁਰਾਣੇ ਲੋਕਾਂ ਦੀ ਇਹ ਸੋਚ ਹੁੰਦੀ ਸੀ ਜਦ ਕਿ ਸਾਨੂੰ ਇਸ ਸੋਚ ਨੂੰ ਖਤਮ ਕਰਨਾ ਚਾਹੀਦਾ ਹੈ ਕਿ ਕੁੜੀ ਅਤੇ ਮੁੰਡੇ ਦੇ ਵਿਚ ਕੋਈ ਵੀ ਫਰਕ ਨਹੀਂ ਹੋਣਾ ਚਾਹੀਦਾ ਦੋਨਾਂ ਨੂੰ ਬਰਾਬਰ ਰੱਖਣਾ ਚਾਹੀਦਾ ਹੈਗਾ ਏ ਆ